ਪੰਜਾਬ ਵਿੱਚ ਬਹੁਤ ਸਾਰੀਆਂ ਮੁੱਖ ਸਿਹਤ ਸੰਭਾਲ ਤਕਨੀਕਾਂ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਆਯੁਸ਼ਮਾਨ ਕਾਰਡ ਇਸਦੇ ਵਿੱਚ ਪੰਜ ਲੱਖ ਤੱਕ ਦਾ ਦਾ ਇਲਾਜ ਬਿਲਕੁਲ ਫਰੀ ਹੁੰਦਾ ਹੈ